ਇਸ ਕਮਿਊਨਿਟੀ ਪ੍ਰੋਗਰਾਮ ਨਾਲ ਜਿਹਨਾਂ ਲੋਕਾਂ ਨੂੰ ਪਾਣੀ ਦੀ ਮਹੱਤਤਾ ਦਾ ਨਹੀਂ ਪਤਾ ਉਹਨਾਂ ਲੋਕਾਂ ਨੂੰ ਪਾਣੀ ਦੀ ਮਹੱਤਤਾ ਦਾ ਪਤਾ ਲੱਗੇਗਾ ਜਿਵੇਂ ਕਿ ਮੁੜ ਵਰਤੋਂ ਯੋਗ ਪਾਣੀ ਦੀਆਂ ਬੋਤਲਾਂ ਵਾਪਿਸ ਪ੍ਰਦਾਨ ਕਰਨੀਆਂ ਪਾਣੀ ਰਿਫਿਲ ਸਟੇਸ਼ਨ ਸਥਾਪਿਤ ਕਰਨ ਵਾਲੇ ਪਤਾ ਲੱਗੇਗਾ ਧਿਆਨ ਨਾਲ ਪਾਣੀ ਦੀ ਵਰਤੋਂ ਬਾਰੇ ਪਤਾ ਲੱਗੇਗਾ ਲੋਕ ਪਾਣੀ ਦੀ ਬਚਾਅ ਹੋਵੇਗਾ